ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਰੋਪੜ ਰੇਲਵੇ ਸਟੇਸ਼ਨ 'ਤੇ ਗੱਲ ਕਰਦੀ ਹਾਂ ਤੁਹਾਡੇ ਨਾਲ ਹਾਂਜੀ ਮੈਮ ਮੈਂ ਇਹ ਪੁੱਛਣਾ ਸੀ ਕਿ ਜਿਹੜੀ ਰੋਪੜ ਤੋਂ ਟ੍ਰੇਨਸ ਜਾਂਦੀਆਂ ਉਹ ਕਿਹੜੀ ਕਿਹੜੀ ਮੇਜਰ ਸਿਟੀਜ਼ ਨੂੰ ਕਨੈਕਟ ਕਰਦੀਆਂ ਠੀਕ ਹੈ ਮੈਮ ਮੈਂ ਜੇ ਅੰਬਾਲਾ ਜਾਣਾ ਹੋਵੇ ਤਾਂ ਮੈਨੂੰ ਕਿਹੜੀ ਕਿਹੜੀ ਟ੍ਰੇਨਸ ਮਿਲ ਸਕਦੀਆਂ ਮੈਨੂੰ ਤੁਸੀਂ ਗਾਈਡ ਕਰੋਂਗੇ ਪਲੀਜ਼ ਅੱਛਾ ਜੀ ਠੀਕ ਹੈ ਜੀ ਠੀਕ ਹੈ ਜੀ ਮੈਮ ਅੋਰ ਟਿਕਟ ਦਾ ਪਰਾਈਜ਼ ਕੀ ਹੈ ਅਤੇ ਅੱਛਾ ਜੀ ਠੀਕ ਹੈ ਜੀ ਸਵੇਰ ਵਾਲੀ ਪੰਜ ਵਜੇ ਵਾਲੀ ਟ੍ਰੇਨ ਦਾ ਕੀ ਚਾਰਜਿਸ ਹੈ ਟੂ ਫਿਫ਼ਟੀ ਠੀਕ ਹੈ ਜੀ ਮੈਮ ਅਤੇ ਗੱਡੀ ਸਮੇਂ 'ਤੇ ਆਉਂਦੀ ਹੈ ਜੀ ਪੂਰੇ ਟਾਈਮ ਨਾਲ ਆਉਂਦੀ ਹੈ ਅੱਛਾ ਜੀ ਪੰਜ ਵਜੇ ਚੱਲ ਕੇ ਕਿੰਨੇ ਵਜੇ ਪਹੁੰਚਾ ਦਿੰਦੀ ਹੈ ਜੀ ਠੀਕ ਹੈ ਜੀ ਠੀਕ ਹੈ ਮੈਮ ਥੈਂਕ ਯੂ ਜੀ ਓਕੇ